ਸਾਡੇ ਫੋਨ ਵਿੱਚ ਬਹੁਤ ਸਾਰੀ ਐਪਸ ਜਿਵੇਂ ਕੈਮਰਾ ਮਿਊਜ਼ਿਕ ਵੈਦਰ ਟੂਲਸ ਵੱਟਸਅਪ ਫੇਸਬੁੱਕ ਗੈਲਰੀ ਇੰਸਟਾਗ੍ਰਾਮ ਯੂ ਟਿਊਬ ਬਹੁਤ ਸਾਰੀ ਐਪਸ ਹਨ ਇਹਨਾਂ ਵਿੱਚੋਂ ਅਸੀਂ ਇੰਸਟਾਗ੍ਰਾਮ ਵੱਟਸਅਪ ਯੂ ਟਿਊਬ ਇਹ ਜਿਆਦਾ ਵਰਤੋਂ ਵਿੱਚ ਲਿਆਉਂਦੇ ਹਾਂ ਇਹ ਸਾਡੇ ਲਈ ਬਹੁਤ ਮਦਦਗਾਰ ਹੈ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਨੋਲੇਜ ਨਹੀਂ ਹੁੰਦੀ ਤਾਂ ਅਸੀਂ ਯੂ ਟੀਊਬ 'ਚੋਂ ਕੱਢ ਕੇ ਦੇਖ ਸਕਦੇ ਹਾਂ ਜੇਕਰ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੁੰਦਾ ਤਾਂ ਅਸੀਂ ਗੂਗਲ ਵਿੱਚੋਂ ਸਰਚ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਅਸੀਂ ਕਿਤੇ ਬੈਠੇ ਹੋਣ ਅਤੇ ਅਸੀਂ ਕਿਤੇ ਕਿਸੇ ਦਿਸ਼ਾ ਬਾਰੇ ਪਤਾ ਕਰਨਾ ਹੋਵੇ ਤਾਂ ਅਸੀਂ ਜੀ ਪੀ ਐੱਸ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਅਸੀਂ ਕਿਤੇ ਬੋਰ ਹੋ ਰਹੇ ਹਾਂ ਤਾਂ ਅਸੀਂ ਆਪਣੇ ਫੋਨ ਵਿੱਚ ਮਿਊਜ਼ਿਕ ਐਪ ਖੋਲ ਕੇ ਗੀਤ ਵਗੈਰਾ ਸੁਣ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜੇਕਰ ਸਾਡ ਅਸੀਂ ਬੈਠੇ ਹੋਣ ਅਤੇ ਪਾਠ ਵਗੈਰਾ ਕਰਨਾ ਹੋਵੇ ਤਾਂ ਅਸੀਂ ਪਾਠ ਵੀ ਆਪਣੇ ਫੋਨ 'ਚੋਂ ਕਰ ਸਕਦੇ ਹਾਂ ਅਤੇ ਜਦੋਂ ਲਾਕਡਾਊਨ ਦਾ ਟਾਈਮ ਸੀ ਉਸ ਟਾਈਮ ਬਹੁਤ ਸਾਰੀ ਐਪਸ ਸਾਨੂੰ ਬਹੁਤ ਸਹੂਲਤ ਦਿੱਤੀ ਜਿਵੇਂ ਕਿ ਸਾਡੇ ਬੱਚੇ ਵੀ ਔਨਲਾਈਨ ਕਲਾਸਾਂ ਹੀ ਜੁਆਇਨ ਕਰ ਰਹੇ ਸਨ ਉਹਦੇ ਵਿੱਚ ਜ਼ੂਮ ਐਪ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜਦੋਂ ਅਸੀਂ ਬੋਰ ਹੋ ਰਹੇ ਹੁੰਦੇ ਹਾਂ ਤਾਂ ਅਸੀਂ ਬਹੁਤ ਸਾਰੀ ਗੇਮਸ ਵੀ ਆਪਣੇ ਫੋਨ ਵਿੱਚ ਭਰ ਲੈਂਦੇ ਹਾਂ ਅਤੇ ਉਹ ਵੀ ਖੇਡ ਸਕਦੇ ਹਾਂ